ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਤੁਸੀਂ ਆਯੂਸ਼ ਉਬਰ ਕੈਬ ਵਾਲ਼ੇ ਬੋਲ ਰਹੇ ਹੋ ਹਾਂਜੀ ਹਾਂਜੀ ਸਰ ਮੈਂ ਅਰਸ਼ਦੀਪ ਤੁਹਾਨੂੰ ਕੱਲ ਕੋਲ ਕੀਤੀ ਸੀ ਉਬਰ ਬੁੱਕ ਕਰਨ ਲਈ ਹਾਂਜੀ ਹਾਂਜੀ ਸਰ ਸਰ ਮੈਂ ਨਵਾਂ ਸ਼ਹਿਰ ਤੋਂ ਚੰਡੀਗੜ੍ਹ ਰੇਲਵੇ ਸਟੇਸ਼ਨ ਤੱਕ ਜਾਣਾ ਏ ਹਾਂਜੀ ਹਾਂਜੀ ਸਰ ਹਾਂਜੀ ਸਰ ਮੈਂ ਦਸ ਵਜੇ ਮੇਰੀ ਟਰੇਨ ਦਾ ਸਮਾਂ ਏ ਅਤੇ ਮੈਂ ਸਾਢੇ ਨੌ ਵਜੇ ਤੱਕ ਉੱਥੇ ਪਹੁੰਚਾਂਗੀ ਹਾਂਜੀ ਹਾਂਜੀ ਸਰ ਹਾਂਜੀ ਸਰ ਫ਼ਿਰ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਕਿੰਨੇ ਵਜੇ ਮੈਨੂੰ ਲੈਣ ਆਓਗੇ ਠੀਕ ਹੈ ਸਰ ਹਾਂਜੀ ਸਰ ਦੋ ਢਾਈ ਘੰਟੇ ਤਾਂ ਲੱਗ ਜਾਣਗੇ ਆਰਾਮ ਨਾਲ ਹਾਂਜੀ ਹਾਂਜੀ ਠੀਕ ਹੈ ਸਰ ਹਾਂਜੀ ਫਿਰ ਤੁਸੀਂ ਮਨ ਸਾਡੇ ਛੇ ਵਜੇ ਮੈਨੂੰ ਕੋਲ ਕਰ ਦਿਓ ਹਾਂਜੀ ਠੀਕ ਹੈ ਸਰ ਠੀਕ ਹੈ ਠੀਕ ਹੈ ਹਾਂਜੀ ਸਰ ਅਤੇ ਏ ਮੈਂ ਮੇਰਾ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਬਹੁਤ ਜ਼ਰੂਰੀ ਇੰਟਰਵਿਊ ਲਈ ਜਾਣਾ ਹੈ ਹਾਂਜੀ ਹਾਂਜੀ ਸਰ ਜੇ ਮੈਂ ਲੇਟ ਹੋ ਗਈ ਫ਼ਿਰ ਮੇਰਾ ਬਹੁਤ ਨੁਕਸਾਨ ਹੋਜੂਗਾ ਹਾਂਜੀ ਹਾਂਜੀ ਸਰ ਪਲੀਜ਼ ਕਿਰਪਾ ਕਰਕੇ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰਿਓ ਠੀਕ ਹੈ ਸਰ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂਜੀ ਧੰਨਵਾਦ